ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਜਰੂਰ ਕਰਾਂਗੇ ਜੀ ਠੀਕ ਐ ਜੀ ਠੀਕ ਐ ਜੀ ਠੀਕ ਐ ਕਿਹੜੇ ਕਿਹੜੇ ਫ਼ੰਕਸ਼ਨ ਹੋਣਗੇ ਥੋੜਾ ਜਿਆ ਮੈਨੂੰ ਆਈਡੀਆ ਦੇ ਦੋਗੇ ਹਾਂਜੀ ਠੀਕ ਐ ਜੀ ਠੀਕ ਐ ਜੀ ਠੀਕ ਐ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜਰੂਰ ਜੀ ਹਾਂਜੀ ਕਰਲਾਂਗੇ ਜੀ ਹਾਂਜੀ ਨਈਂ ਜੀ ਨਈਂ ਜੀ ਬਿਲਕੁਲ ਜਰੂਰ ਜੀ ਆਪਦੇ ਤਰਫ ਤੋਂ ਤਾਂ ਅਸੀਂ ਕੰਮ ਪੂਰਾ ਵਧੀਆ ਕਰਾਂਗੇ ਜੀ ਹਾਂਜੀ ਹਾਂਜੀ ਹਾਂਜੀ ਸਾਡਾ ਕੰਮ ਬਹੁਤ ਵਧੀਆ ਏ ਸਾਡਾ ਨਾਂਅ ਵੀ ਬਹੁਤ ਵਧੀਆ ਲੱਗਦਾ ਐ ਸਾਰਿਆਂ ਨੂੰ ਤੇ ਤੁਸੀਂ ਮੈਨੂੰ ਐਨਾ ਆਈਡੀਆ ਦੇ ਦੋ ਤੁਹਾਡਾ ਜਿਹੜੇ ਸਾਈਡ ਤੇ ਘਰ ਹੋਏਗਾ ਤੇ ਸਾਰੇ ਰੈਲੇਟਿਵ ਘਰ ਈ ਆਉਣਗੇ ਓਥੇ ਈ ਕਰਨੀ ਹੈਗੀ ਕੋਈ ਅਲੱਗ ਤੁਸੀਂ ਲਿੱਤਾ ਹੋਇਆ ਠੀਕ ਐ ਠੀਕ ਐ ਜੀ ਠੀਕ ਐ ਹਾਂਜੀ ਹਾਂਜੀ ਹਾਂਜੀ ਮੈਨੂੰ ਇਹ ਆਈਡੀਆ ਦੇਦੋ ਕੀ ਕਿੰਨੇ ਕ ਵਜੇ ਤੱਕ ਪਹੁੰਚ ਜਾਣ ਸਵੇਰੇ ਠੀਕ ਐ ਜੀ ਹਾਂਜੀ ਹਾਂਜੀ ਨਈਂ ਨਈਂ ਜੀ ਨਈਂ ਜੀ ਜਰੂਰ ਜਿੰਨੇ ਵਜੇ ਤੁਸੀਂ ਦਸ ਵਜੇ ਟਾਈਮ ਦੇਤਾ ਮੈਂ ਦਸ ਵਜੇ ਪਹੁੰਚ ਜਾਵਾਂਗੇ ਕੋਈ ਗੱਲ ਨੀ ਜੀ ਕਰ ਲਾਂਗੇ ਆਪਾਂ ਪੈਸਿਆਂ ਵਲੋਂ ਕੋਈ ਨੀ ਤੁਸੀਂ ਪਹਿਲਾਂ ਕੰਮ ਦੇਖ ਲੈਣਾ ਫੇਰ ਆਪਾਂ ਕਰਲਾਂਗੇ ਪੈਸਿਆਂ ਦਾ ਹਾਂਜੀ ਹਾਂਜੀ ਹਾਂਜੀ ਜਰੂਰ ਜੀ ਜਰੂਰ ਮੈਂ ਦੋ ਕ ਦਿਨ ਪਹਿਲਾਂ ਈ ਆ ਜਾਵਾਂਗੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਮੈਨੂੰ ਤੁਸੀਂ ਪਹਿਲਾਂ ਸਾਰਾ ਮੈਨੂੰ ਦੱਸ ਦੇਣਾ ਮੈਂ ਓਨੇ ਵਜੇ ਈ ਆ ਜਾਵਾਂਗੀ ਦੋ ਦਿਨ ਪਹਿਲਾਂ ਹਾਂਜੀ ਜਰੂਰ ਜੀ ਮੈਂ ਈ ਆਵਾਂਗੀ ਠੀਕ ਐ ਜੀ ਹਾਂਜੀ ਹਾਂਜੀ ਜਰੂਰ ਦਸ ਵਜੇ ਠੀਕ ਐ ਵੈਲ ਵੈਲਕਮ ਓਕੇ